ਸਤਿ ਸ੍ਰੀ ਅਕਾਲ ਮੈਮ ਤੁਸੀਂ ਸਪਾਰਕ ਹੋਟਲ ਦੇ ਰਿਸੈਪਸ਼ਨ ਬੋਲਦੇ ਪਏ ਹੋ ਮੈ ਔਡਰ ਦੇਣਾ ਸੀ ਇੱਕ ਪੀਜ਼ਾ ਇੱਕ ਕੋਕ ਦਾ ਹਾਂਜੀ ਮੀਡੀਅਮ ਸਾਈਜ਼ ਪੀਜ਼ਾ ਕਰ ਦਿਉ ਹਾਂਜੀ ਅਤੇ ਵੈੱਜ ਵੈੱਜ ਪਨੀਰ ਪੀਜ਼ਾ ਹਾਂਜੀ ਬਸ ਇਹੀ ਕਰ ਦਿਉ ਰੂਮ ਨੰਬਰ ਮੇਰਾ ਬਾਰਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਇੱਕ ਔਡਰ ਹੋਰ ਲਿਖ ਦਿਉ ਮਨਚੂਰੀਅਨ ਵੀ ਐਡ ਕਰ ਦਿਉ ਉਹਦੇ 'ਚ ਨਿਊਡਲਸ ਵੀ ਹਾਂਜੀ ਹਾਫ ਪਲੇਟ ਹਾਂਜੀ ਹਾਂਜੀ

ਹੋਰ ਕੁਛ ਨਹੀਂ ਧੰਨਵਾਦ ਜੀ